ਕਈ ਲੋਕ ਖਾਣਾ ਬਣਾਉਣ ਨੂੰ ਆਪਣਾ ਪੇਸ਼ੇ ਦੇ ਤੌਰ 'ਤੇ ਅਪਣਾਉਣਾ ਚਾਹੁੰਦੇ ਹਨ ਉਹਨਾਂ ਨੂੰ ਇਹ ਸਿਖਲਾਈ ਦਿੱਤੀ ਜਾਂਦੀ ਹੈ ਕਿ ਸਭ ਤੋਂ ਪਹਿਲੇ ਮਸਾਲਿਆਂ ਬਾਰੇ ਪਤਾ ਕਰ ਸਬਜ਼ੀ ਇੱਕ ਵਧੀਆ ਕਿਹੜੀ ਹੁੰਦੀ ਹੈ ਘਟੀਆ ਕਿਹੜੀ ਹੁੰਦੀ ਹੈ ਸਰਦੀਆਂ 'ਚ ਕਿਹੜੀ ਸਬਜ਼ੀਆਂ ਨੇ ਗਰਮੀਆਂ 'ਚ ਕਿਹੜੀਆਂ ਸਬਜ਼ੀਆਂ ਮਿਲਦੀਆਂ ਨੇ ਉਸ ਤੋਂ ਬਾਅਦ ਇਹਨਾਂ ਦੀ ਸਪੈਸ਼ਲ ਇੱਕ ਕੋਚਿੰਗ ਲੱਗਦੀ ਹੈ ਜਸਟ ਉਹ ਕਿ ਹੋਟਲ ਮੈਨੇਜਮੈਂਟ ਕਾਲਜ ਵੀ ਕਿਹਾ ਜਾਂਦਾ ਹੈ ਬਾਰਵੀਂ ਤੱਕ ਤਾਂ ਸਾਰਿਆਂ ਨੂੰ ਸੇਮ ਹੀ ਪੜ੍ਹਾਈ ਦਿੱਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਤੁਸੀਂ ਹੋਟਲ ਮੈਨੇਜਮੈਂਟ ਰਹਿ ਕੇ ਅਤੇ ਆਪਣਾ ਖਾਣਾ ਵਧਾਉਣ ਵੱਲ ਜਾ ਸਕਦੇ ਹੋ ਬਟ ਕੁਝ ਲੋਕ ਤੁਹਾਨੂੰ ਰੋਕਦੇ ਵੀ ਹੈ ਨਹੀਂ ਕਿ ਤੂੰ ਮਰਦ ਆ ਤੂੰ ਰੋਟੀ ਕਿਉਂ ਬਣਾਉਣੀ ਹੈ ਘਰ ਬਹਿ ਜਨਾਨੀ ਨੂੰ ਰੋਟੀ ਬਣਾ ਕੇ ਦੇਗੀ ਪਰ ਨਹੀਂ ਇਹ ਗਲਤ ਆ ਸਾਨੂੰ ਸਾਰਿਆਂ ਨੂੰ ਇਹ ਸਿਖਾਉਣਾ ਚਾਹੀਦਾ ਹੈ ਕਿ ਖਾਣਾ ਇੱਕ ਬਹੁਤ ਹੀ ਜ਼ਰੂਰੀ ਚੀਜ਼ ਹੈ ਤਾਂ ਹਰ ਇੱਕ ਬੰਦੇ ਨੂੰ ਖਾਣਾ ਬਣਾਉਣਾ ਆਉਣਾ ਚਾਹੀਦਾ ਹੈ ਬਟ ਜੇ ਕੋਈ ਇਹਨੂੰ ਪੇਸ਼ੇ ਦੇ ਤੌਰ 'ਤੇ ਕਰਦਾ ਹੈ ਤਾਂ ਉਸ ਨੂੰ ਬਹੁਤ ਲੋਕ ਰੋਕਦੇ ਨੇ ਉਸਨੂੰ ਨ ਨਕਾਰਿਆ ਜਾਂਦਾ ਹੈ ਕਿ ਤੂੰ ਇੱਕ ਜਨਾਨਾ ਕਾ ਹਾਂ ਤੂੰ ਰੋਟੀ ਨਹੀਂ ਬਣਾ ਸਕਦਾ ਬਟ ਜੇ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਇਹ 'ਚ ਕੋਈ ਉਹ ਨਹੀਂ ਹੈ ਸਰਕਾਰ ਨੇ ਵੀ ਹੋਟਲ ਮੈਨੇਜਮੈਂਟ ਵਗੈਰਾ ਬਹੁਤ ਖੋਲ੍ਹੇ ਹੋਏ ਨੇ ਜਿੱਥੇ ਜਾ ਕੇ ਤੁਸੀਂ ਖਾਣਾ ਬਣਾਉਣਾ ਸਿੱਖ ਸਕਦੇ ਹੋ ਸਭ ਤੋਂ ਵਧੀਆ ਇਹੀ ਹੈ ਕਿ ਤੁਸੀਂ ਆਪਣੇ ਘਰ ਆਪਣੇ ਦਾਦੀ ਜਾਂ ਮੰਮੀ ਕੋਲ ਹੀ ਖਾਣਾ ਬਣਾਉਣਾ ਸਿੱਖੋ ਸਭ ਤੋਂ ਪਹਿਲੇ ਉਸਨੇ ਇਹ ਹੈਗਾ ਕਿ ਤੁਹਾਨੂੰ ਥੋੜ੍ਹਾ ਬਹੁਤ ਪਤਾ ਲੱਗ ਜੇ ਕਿ ਖਾਣਾ ਕਿਵੇਂ ਬਣਾਉਂਦੇ ਨੇ ਅਤੇ ਖਾਣਾ ਬਣਾਉਣਾ ਕੋਈ ਮਾੜੀ ਚੀਜ਼ ਵੀ ਨਹੀਂ ਹੈ ਕੀ ਪਤਾ ਕਦੋਂ ਬੰਦੇ ਨੂੰ ਇਕੱਲਾ ਰਹਿਣਾ ਪੈ ਜਾਵੇ ਅਤੇ ਖਾਣਾ ਬਣਾਉਣ ਦੀ ਲੋੜ ਪੈ ਜੇ ਮੈਂ ਤਾਂ ਚਾਹੁੰਦਾ ਹਾਂ ਹਰ ਇੱਕ ਨੂੰ ਖਾਣਾ ਬਣਾਉਣਾ ਆਉਣਾ ਚਾਹੀਦਾ ਹੈ